ਮੋਹਾਲੀ ਜ਼ਿਲ੍ਹੇ ਦੇ ਅੰਦਰ ਧਾਰਮਿਕ ਸਥਾਨ ਇਤਿਹਾਸਿਕ ਸਥਾਨ ਆਦਿ ਜਿਹੜੇ ਬਹੁਤ ਹੀ ਵਿਸ਼ ਵਿਸ਼ੇਸ਼ਤਾਵਾਂ ਰੱਖਦੇ ਹਨ ਸਾਡੀ ਸੱਭਿਆਚਾਰਕ ਸਾਂਝ ਨੂੰ ਪਰਪੱਕਤਾ ਕਰਦੇ ਹਨ ਜਿਨ੍ਹਾਂ ਦੇ ਵਿੱਚ ਮੋਹਾਲੀ ਸ਼ਹਿਰ ਦੇ ਅੰਦਰ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਪਾਤਸ਼ਾਹੀ ਸੱਤਵੀਂ ਬਹੁਤ ਹੀ ਮਹੱਤਵਪੂਰਨ ਸਥਾਨ ਹੈ ਰਮਣੀਕ ਸਥਾਨ ਹੈ ਉਸਦੇ ਨਾਲ ਹੀ ਸੋਹਾਣਾ ਗੁਰਦੁਆਰਾ ਸਾਹਿਬ ਇਹ ਵੀ ਰਮਣੀਕ ਸਥਾਨ ਹੈ ਕੁਰਾਲੀ ਸ਼ਹਿਰ ਦੇ ਅੰਦਰ ਮਾਤਾ ਸ਼ੀਤਲਾ ਦਾ ਮੰਦਰ ਜਿੱਥੇ ਦੂਰੋਂ ਦੁਰੇਡੋ ਲੋਕ ਆ ਕੇ ਸਾਲ ਭਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰਦੇ ਨੇ ਮੋਹਾਲੀ ਜ਼ਿਲ੍ਹੇ ਦੇ ਅੰਦਰ ਡੈਮ ਸਾਡੇ ਮੋਹਾਲੀ ਜ਼ਿਲ੍ਹੇ ਨੂੰ ਬਹੁਤ ਹੀ ਚਾਰ ਚੰਨ ਲਾਉਂਦੇ ਹਨ ਅਤੇ ਪਹਾੜੀ ਖੇਤਰ ਰਮਣੀਕ ਸਥਾਨ ਹੈ ਇੱਥੇ ਛੁੱਟੀ ਵਾਲੇ ਦਿਨ ਜਾਂ ਹੋਰ ਵਿਹਲੇ ਸਮੇਂ ਦੇ ਅੰਦਰ ਲੋਕ ਜਾ ਕੇ ਆਪਣੇ ਸਰੀਰ ਨੂੰ ਰਿਸਟ ਪੁਸ਼ਟ ਰੱਖਣ ਦੇ ਲਈ ਪਹੁੰਚਦੇ ਨੇ ਘੁੰਮਦੇ ਫਿਰਦੇ ਨੇ ਆਪਣਾ ਸਮਾਂ ਜਿਹੜਾ ਏ ਉੱਥੇ ਬਤੀਤ ਕਰਦੇ ਨੇ